ਮੈਂ ਘੁੰਮਣ ਦਾ ਬਹੁਤ ਸ਼ੌਕੀਨ ਹਾਂ ਅਤੇ ਘੁੰਮਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਪਰ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੀ ਪਤਨੀ ਆਪਣੇ ਬੱਚੇ ਨਾਲ ਅਤੇ ਆਪਣੇ ਸਾਰੇ ਪਰਿਵਾਰ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਹੀ ਘੁੰਮਣਾ ਜ਼ਿਆਦਾ ਪਸੰਦ ਕਰਦਾ ਹਾਂ ਕਿਉਂਕਿ ਘੁੰਮਣ ਦੇ ਜਾਣ ਦੇ ਦੌਰਾਨ ਅਗਰ ਜੇਕਰ ਪਰਿਵਾਰ ਸਾਰਾ ਤੁਹਾਡੇ ਨਾਲ ਹੈ ਸਾਥ ਹੈ ਤਾਂ ਤੁਸੀਂ ਹਰੇਕ ਉਸ ਪਲ ਨੂੰ ਬੜੀ ਅੱਛੇ ਤਰੀਕੇ ਨਾਲ ਮਹਿਸੂਸ ਕਰ ਸਕਦੇ ਹੋ ਉਹਨੂੰ ਮਾਣ ਸਕਦੇ ਹੋ ਜਿਹੜਾ ਕਿ ਤੁਸੀਂ ਦੇਖਿਆ ਹੋਵੇਗਾ ਕਿਉਂਕਿ ਇਕੱਲੇ ਘੁੰਮਣ ਦੇ ਨਾਲ ਉਹ ਪਲ ਉਹ ਉਹ ਘੜੀਆਂ ਤੁਸੀਂ ਆਪਣੇ ਪਰਿਵਾਰ ਤੋਂ ਨੂੰ ਨਾ ਸਮਝਾ ਸਕਦੇ ਹੋ ਨਾ ਦੱਸ ਸਕਦੇ ਹੋ ਜੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੋ ਕੇ ਇਹ ਮਹਿਸੂਸ ਕਰ ਸਕਦੇ ਹੋ ਸਮਝ ਸਕਦੇ ਹੋ ਘੁੰਮਣਾ ਇੱਕ ਇੱਕ ਐਸੀ ਸ਼ੈਲੀ ਹੈ ਐਸੀ ਇੱਕ ਵਿਧੀ ਹੈ ਜਿਸ ਨਾਲ ਤੁਸੀਂ ਹੋਰ ਲੋਕਾਂ ਨੂੰ ਵੀ ਮਿਲ ਸਕਦੇ ਹੋ ਹੋਰ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਾਰੇ ਸਮਝ ਸਕਦੋ ਹੋ ਉਹਨਾਂ ਦੇ ਵਿਚਾਰ ਸਮਝ ਸਕਦੇ ਹੋ ਇਸ ਲਈ ਮੈਨੂੰ ਆਪਣੇ ਪਰਿਵਾਰ ਦੇ ਨਾਲ ਜਾ ਕੇ ਹੋਰ ਜਗ੍ਹਾ 'ਤੇ ਘੁੰਮਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਉਹਨਾਂ ਦੇ ਨਾਲ ਉੱਥੇ ਦਾ ਖਾਣਾ ਖਾਣਾ ਉੱਥੇ ਦਾ ਕਲਚਰ ਦੇਖਣਾ ਉੱਥੇ ਦਾ ਸੱਭਿਆਚਾਰ ਉੱਥੇ ਦਾ ਸਮਾਜਿਕ ਰਹਿਣ ਸਹਿਣ ਉੱਥੇ ਦੇ ਵਿਹਾਰ ਦੇਖਣ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਹੀ ਘੁੰਮਣ ਜਾਣ ਦੇ ਨਾਲ ਜਿਹੜਾ ਮਨੋਬਲ ਅਤੇ ਮਨੋਵਿਗਿਆਨਿਕ ਤੌਰ 'ਤੇ ਜਿਹੜਾ ਦਿਮਾਗ ਦਾ ਸੰਤੁਲਨ ਹੈ ਉਹ ਵੀ ਸਹੀ ਰਹਿੰਦਾ ਹੈ